ਵਿਆਹਾਂ ਸਮਾਰੋਹ ਦੌਰਾਨ ਵੱਡੀ ਮਾਤਰਾ ਵਿਚ ਪਾਣੀ ਦੀ ਮੱਤ ਪਾਣੀ ਦਾ ਪ੍ਰਬੰਧ ਕਰਨ ਸੰਬੰਧੀ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪਾਣੀ ਟੂਟੀਆਂ ਟੈਂਕੀਆਂ ਜਾਂ ਮੋਟਰਾਂ ਰਾਹੀਂ ਕੀਤਾ ਜਾਂਦਾ ਹੈ ਉੱਥੇ ਬ ਟੈਂਕੀ ਵਾਲੇ ਨੂੰ ਕਿਹਾ ਜਾਂਦਾ ਵੀ ਇਹ ਪਾਣੀ ਸਾਰਾ ਦਿਨ ਚਲੀ ਜਾਵੇ ਚੌਵੀ ਘੰਟੇ ਉਸ ਤੋਂ ਬਾਅਦ ਜੋ ਪਾਣੀ ਦੀ ਮਾਤਰਾ ਉਹ ਬਹੁਤ ਛੇਤੀ ਪ੍ਰਬੰਧ ਹੋ ਜਾਂਦਾ ਪਿੰਡਾਂ ਦੇ ਵਿੱਚ ਕਿਵੇਂ ਬੜੀਆਂ ਸਮਰਸੀਵਲ ਮੋਟਰ ਹੋਰ ਨੇ ਪਰ ਸ਼ਹਿਰਾਂ ਦੇ ਵਿੱਚ ਵਿਆਹਾਂ ਦੇ ਵਿੱਚ ਸ਼ਹਿਰ ਦੇ ਵਿੱਚ ਵਿਆਹ ਹੋਵੇ ਉਹ ਹੋਰ ਤਰੀਕੇ ਨਾਲ ਹੁੰਦਾ ਉਹਦੇ ਵਿੱਚ ਕਿਵੇਂ ਡਿਪੋਜਲ ਗਲਾਸ ਬਿਸ਼ਲਰੀ ਦੀਆਂ ਬੋਤਲਾਂ ਪੀਣ ਵਾਸਤੇ ਉਹ ਉਹ ਵਰਤ ਹੋ ਜਾਂਦਾ ਦਾ ਅਤੇ ਸ ਸਮਾਨ ਬਣਾਉਣ ਲਈ ਵਿਆਹ ਦੇ ਵਿੱਚ ਸਬਜ਼ੀਆਂ ਭਾਜੀਆਂ ਦੇ ਵਿੱਚ ਉਹ ਟੈਂਕਰ ਦੀ ਵਰਤੋਂ ਕੀਤੀ ਜਾਂਦੀ ਹੈ ਕਿਵੇਂ ਟੈਂਕੀ ਪਾਣੀ ਦੀ ਭਰ ਕੇ ਬਾਹਰੋਂ ਲੈ ਆਉਂਦੇ ਨੇ ਬੰਦੇ ਤਾਂ ਉਸਨੂੰ ਉਹ ਟੈਂਕੀ ਰਾਹੀਂ ਵਰਤਿਆ ਜਾਂਦਾ ਉਹ ਤੋਂ ਬਾਅਦ ਸਮਰਸੀਵਲ ਵੀ ਮੋਟਰਾਂ ਹੁੰਦੀਆਂ ਨੇ ਜੋ ਉਹਨਾਂ ਨਾਲ ਸਿਰੇ 'ਚ ਰਹਿ ਜਾਂਦਾ ਹੈ